ਮੇਰਾ ਇਲਾਕਾ ਬਹੁਤ ਹੀ ਸਾਫ਼ ਸੁਥਰਾ ਹੈ ਮੈਂ ਇੱਥੇ ਅਸਮਾਨ ਵਿੱਚ ਹਰੇਕ ਚੀਜ਼ ਸਾਫ਼ ਸੁਥਰੇ ਢੰਗ ਨਾਲ਼ ਦੇਖ ਸਕਦਾ ਹਾਂ ਮੈਨੂੰ ਇੱਥੇ ਦੇਖਣ ਨਾਲ਼ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ